ਕੀ ਤੁਸੀਂ ਕਦੇ ਕੋਈ ਅਜਿਹੀ ਚੀਜ਼ ਬਣਾਈ ਹੈ ਜਿਸ ਦੇ ਤੁਹਾਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਇਸ ਦਾ ਡੂੰਘਾ ਅਰਥ ਹੈ ਜਾਂ ਬਹੁਤ ਮਹੱਤਵ ਹੈ ਅਤੇ ਤੁਸੀਂ ਕੀ ਮੈਨੂੰ ਇਸ ਬਾਰੇ ਦੱਸ ਸਕਦੇ ਹੋ ਜੀ ਹਾਂ ਮੈਂ ਤੁਹਾਨੂੰ ਇਸ ਬਾਰੇ ਬਹੁਤ ਕੁਝ ਦੱਸ ਸਕਦਾ ਹਾਂ ਜਿਵੇਂ ਕਿ ਕੁਛ ਦਿਨਾਂ ਪਹਿਲਾਂ ਮੈਂ ਇੱਕ ਪੇਂਟਿੰਗ ਬਣਾਈ ਸੀਗੀ ਜੋ ਕਿ ਇੱਕ ਲੈਂਡਸਸਕੇਪ ਸੀਗਾ ਅਸਲ ਵਿੱਚ ਬਹੁਤ ਹੀ ਸੋਹਣੀ ਪੇਂਟਿੰਗ ਬਣਾਈ ਸੀ ਅਤੇ ਉਸਨੂੰ ਬਣਾਉਣ ਵੇਲੇ ਮੈਨੂੰ ਬਹੁਤ ਹੀ ਦਿੱਕਤਾਂ ਆਈਆਂ ਸੀ ਪਰ ਮੈਂ ਤਾਂ ਵੀ ਉਸਨੂੰ ਕਿਸੇ ਤਰ੍ਹਾਂ ਪੂਰਾ ਕੀਤਾ ਅਤੇ ਫਿਰ ਇੱਕ ਕੋਂਪਟੀਸ਼ਨ ਵੀ ਉਹਦੇ ਬਾਰੇ ਹੀ ਜਿੱਤਿਆ ਉਸ ਤੋਂ ਬਾਅਦ ਫਿਰ ਕੁਛ ਦਿਨਾਂ ਬਾਅਦ ਜਦ ਮੈਂ ਉਸ ਨੂੰ ਲੈ ਕੇ ਘਰ ਆਇਆ ਮੇਰੇ ਘਰ ਸਭ ਕੁਛ ਖੁਸ਼ ਹੋ ਗਏ ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮੈਂ ਇੱਕ ਕੋਂਪਟੀਸ਼ਨ ਜਿੱਤਿਆ ਸੀ ਬਹੁਤ ਦਿੱਕਤਾਂ ਦੇ ਬਾਅਦ ਉਹ ਵੀ ਡਰਾਇੰਗ ਵਿੱਚ ਉਸ ਤੋਂ ਬਾਅਦ ਮੈਂ ਉਹਨੂੰ ਕਿਤੇ ਰੱਖ ਦਿੱਤਾ ਅਤੇ ਕੁਛ ਦਿਨਾਂ ਦੇ ਬਾਅਦ ਮੈਂ ਜਦੋਂ ਉਸਨੂੰ ਲੱਭਣ ਲੱਭਣ ਲੱਗਾ ਕਿਉਂਕਿ ਮੈਂ ਆਪਣੇ ਦੋਸਤ ਨੂੰ ਵੀ ਦਿਖਾਉਣੀ ਸੀ ਮੈਂ ਬਹੁਤ ਹੀ ਵਧੀਆ ਬਣਾ ਦਿੱਤੀ ਸੀ ਉਹ ਪੇਂਟਿੰਗ ਤਾਂ ਮੈਨੂੰ ਨਹੀਂ ਲੱਭੀ ਮੈਂ ਪਰੇਸ਼ਾਨ ਹੋ ਗਿਆ ਮੈਂ ਹੈਰਾਨ ਸੀ ਕਿ ਮੈਂ ਇੱਥੇ ਰੱਖੀ ਕਿੱਥੇ ਗਈ ਮੈਂ ਬਹੁਤ ਹੀ ਉਸ ਚੀਜ਼ ਨੂੰ ਲੱਭਿਆ ਫਿਰ ਮੈਨੂੰ ਹੌਲੀ ਹੌਲੀ ਮੈਂ ਆਪਣੀ ਸਾਰੀ ਚੀਜ਼ਾਂ ਯਾਦ ਕੀਤੀਆਂ ਮੈਂ ਉਹਨੂੰ ਬਣਾਉਂਦੇ ਹੋਏ ਕੀ ਸੋਚਦਾ ਪਿਆ ਸੀਗਾ ਮੈਂ ਕਿੱਧਰ ਵੇਖਦਾ ਪਿਆ ਸੀਗਾ ਮੇਰੇ ਮਨ ਦੇ ਭਾਵ ਕਿੱਦਾਂ ਦਾ ਸੀ ਮੈਂ ਸਭ ਕੁਝ ਸੋਚਿਆ ਇਸ ਨਾਲ ਫਿਰ ਮੈਂ ਉਹਨੂੰ ਆਪਣੇ ਦਿਲੋਂ ਲੱਭਣਾ ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਉਹਨੂੰ ਲੱਭਿਆ ਤਾਂ ਮੈਨੂੰ ਸਮਝ ਆਈ ਕਿ ਅਸਲ 'ਚ ਉਸ ਕਿ ਇੱਕ ਆਮ ਜਿਹੀ ਡਰਾਇੰਗ ਸੀ ਜੋ ਮੈਂ ਬਣਾਈ ਸੀ ਅਸਲ ਵਿੱਚ ਉਹ ਬਹੁਤ ਹੀ ਵੱਡੀ ਚੀਜ਼ ਮਿਲ ਗਈ ਕਿਉਂਕਿ ਉਹ ਉਹਦੇ 'ਚ ਮੈਂ ਮਿਹਨਤ ਕੀਤੀ ਸੀਗੀ ਉਹ ਅਸਲ 'ਚ ਮੈਨੂੰ ਮੇਰੇ ਬਾਰੇ ਦੱਸਦੀ ਸੀਗੀ ਉਹਨਾਂ ਮੈਂ ਅਗਰ ਮੈਂ ਉਸ ਚੀਜ਼ ਨੂੰ ਉਸ ਡਰਾਇੰਗ ਨੂੰ ਕਿਸੇ ਨੂੰ ਦਿਖਾਵਾਂ ਤਾਂ ਉਹ ਮੇਰੀ ਹਾਲਤ ਸਮਝ ਸਕਦਾ ਸੀਗਾ ਅਗਰ ਹੋਰ ਕੋਈ ਸਮਝੇ ਜਾਂ ਨਾ ਵੀ ਸਮਝੇ ਉਹਨੂੰ ਮੈਂ ਖੁਦ ਦੇਖ ਕੇ ਮੈਂ ਆਪਣੀ ਹਾਲਤ ਸਮਝ ਸਕਦਾ ਉਹਨੂੰ ਬਣਾਉਣ ਲਈ ਮੈਂ ਕਿੰਨੀ ਮਿਹਨਤ ਕੀਤੀ ਆ ਉਹਦੇ ਲਈ ਮੈਂ ਕਿੰਨਾ ਜ਼ੋਰ ਲਾਇਆ ਵਾ ਉਹਦੇ ਲਈ ਮੈਂ ਕਿੰਨੀ ਜ਼ਿਆਦਾ ਤਿਆਰੀ ਕੀਤੀ ਆ ਫਿਰ ਜਾ ਕੇ ਉਹ ਡਰਾਇੰਗ ਮੈਨੂੰ ਫਿਰ ਲਾਸਟ 'ਚ ਮਿਲ ਗਈ ਅਤੇ ਇ ਇਸ ਇੱਕ ਘਟਨਾ ਨਾਲ ਮੈਨੂੰ ਸਮਝ ਆਇਆ ਕਿ ਉਸਦਾ ਅਰਥ ਕੀ ਹੈ ਅਗਰ ਇਹ ਮੇਰੀ ਡਿਜਾਇੰਗ ਕਦੀ ਨਾ ਗੁੰਮਦੀ ਤਾਂ ਮੈਨੂੰ ਨਾ ਪਤਾ ਲੱਗਦਾ ਕਿ ਉਹਦਾ ਅਰਥ ਕੀ ਉਸ ਡਰਾਇੰਗ ਦਾ ਉਹਨੂੰ ਸ਼ਾਇਦ ਮੈਂ ਬਾਅਦ 'ਚ ਭੁੱਲ ਵੀ ਜਾਂਦਾ ਪਰ ਹੁਣ ਉਹ ਮੇਰੇ ਦਿਲ 'ਚ ਬਹਿ ਗਈ ਉਹ ਡਰਾਇੰਗ ਅਤੇ ਮੈਂ ਆਪਣੇ ਬਾਰੇ ਹੋਰ ਕੁਛ ਜਾਣਿਆ ਆਪਣੀ ਡਿਜ਼ਾਇੰਗ ਦੇ ਬਾਰੇ ਹੋਰ ਕੁਛ ਜਾਣਿਆ ਉਸ ਇੱਕ ਡਰਾਇੰਗ ਦੇ ਕਰਕੇ ਧੰਨਵਾਦ